ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਆਪਣੀ ਪੰਜਾਬ ਦੀ ਧਰਤੀ ਹੈ ਜਿਹੜੀ

ਪਾਕਿਸਤਾਨ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਬਾਕੀ ਜਿਹੜੇ ਜਿਹਲਮਮ ਅਤੇ ਚਨਾਬ ਹੈ ਜੀ ਇਹ ਪਾਕਿਸਤਾਨ ਦੇ ਵਿੱਚ ਵੀ ਵਹਿੰਦਾ ਏ ਜੀ ਜਿਹਲਮ ਅਤੇ ਚਨਾਬ ਪਾਕਿਸਤਾਨ ਵਿੱਚ ਦੀ ਵਹਿੰਦਾ ਅਤੇ ਬਿਆਸ ਦਰਿਆ ਹੈ ਜੀ ਜਿਹੜਾ ਬਿਆਸ ਦਰਿਆ ਇਹ ਕਪੂਰਥਲਾ ਹੁਸ਼ਿਆਰਪੁਰ ਸ਼ਹਿਰ ਗੁਰਦਾਸਪੁਰ ਸ਼ਹਿਰ ਅੰਮ੍ਰਿਤਸਰ ਸ਼ਹਿਰ ਤਰਨਤਾਰਨ ਸ਼ਹਿਰ ਇਹਦੇ ਵਿੱਚ ਵੀ ਵਹਿੰਦਾ ਜੀ ਠੀਕ ਹੈ ਜੀ ਅਤੇ ਜਿਹੜਾ ਰਾਵੀ ਹੈ ਜੀ ਰਾਵੀ ਰਾਵੀ ਗੁਰਦਾਸਪੁਰ ਸ਼ਹਿਰ ਅੰਮ੍ਰਿਤਸਰ ਸ਼ਹਿਰ ਹਰੀਕੇ ਪੱਤਣ ਵਿੱਚ ਸਤਲੁਜ ਅਤੇ ਬਿਆਸ ਵਿੱਚ ਜੀ ਵਿੱਚ ਰਲਦੇ ਆ ਜੀ ਆ ਕੇ ਠੀਕ ਆ ਜੀ ਇਹ ਰਾਵੀ ਆ ਜੀ ਇਹ ਜਿਹੜਾ ਪਾਣੀ ਹੈ ਆਪਣੇ ਅੱਜ ਕੱਲ੍ਹ ਮਤਲਬ ਕਿ ਬਹੁਤ ਜ਼ਿਆਦਾ ਜ਼ਰੂਰੀ ਹੋ ਰਿਹਾ ਇਹਨਾਂ ਦਰਿਆਵਾਂ ਦਾ ਪਾਣੀ ਬਹੁਤ ਹੀ ਜ਼ਿਆਦਾ ਪਵਿੱਤਰ ਅਤੇ ਸਾਫ ਹੁੰਦਾ ਹੈ ਪਰ ਕੀ ਹੋ ਗਿਆ ਕਿ ਅੱਜ ਕੱਲ੍ਹ ਅੱਜ ਕੱਲ੍ਹ ਪਾਣੀ ਦੀ ਇੰਨੀ ਕੁ ਵਰਤੋਂ ਹੋ ਚੁੱਕੀ ਹੈ ਦੁਰਵਰਤੋਂ ਜ਼ਿਆਦਾ ਕਰ ਰਹੇ ਲੋਕ ਆਮ ਕਰਕੇ ਅੱਗੇ ਪਾਣੀ ਦਾ ਨਲਕੇ ਨੂੰ ਜੋੜਦੇ ਸੀ ਅਤੇ ਉਹਦਾ ਬਹੁਤ ਵਧੀਆ ਚੱਲਦਾ ਸੀ ਪਰ ਅੱਜ ਕੱਲ੍ਹ ਨਾ ਮਤਲਬ ਕਿ ਇਹਨਾਂ ਇਹਨਾਂ ਇਸ ਪਾਣੀ ਦੀ ਜਿਊਜ ਆ ਜਿਹੜੀ ਕਰਦੇ ਜਿਹੜੀ ਆਪਾਂ ਇਹ ਬਹੁਤ ਜਿਆਦਾ ਮਤਲਬ ਕੀ ਹੋ ਰਹੀ ਹ ਪਰ ਅੱਜ ਕੱਲ੍ਹ ਪਾਣੀ ਆ ਨਾ ਜਿਹੜਾ ਇਹ ਜ਼ਿਆਦਾ ਦੂਸ਼ਿਤ ਕਰੀ ਜਾਂਦੇ ਆ ਆਮ ਲੋਕ ਘਰਾਂ ਦੇ ਵਿੱਚ ਸਾਡੀਆਂ ਕਈ ਭੈਣਾਂ ਹੁੰਦੀਆਂ ਅਤੇ ਜਿਸ ਤਰੀਕੇ ਜਿਵੇਂ ਹੁਣ ਛੋਟੀਆਂ ਨਹਿਰਾਂ ਜਿਹੜੀਆਂ ਕੱਚੀਆ ਅਤੇ ਵੱਡੀਆਂ ਇਹਨਾਂ ਦੇ ਵਿੱਚ ਲੋਕ ਕੂੜਾ ਕਰਕਟ ਬਹੁਤ ਸੁੱਟੀ ਜਾਂਦੇ ਆ ਪਾਣੀ ਬਹੁਤ ਦੂਸ਼ਿਤ ਹੋ ਰਿਹਾ ਕਿਉਂਕਿ ਅੱਗੇ ਲੋਕ ਆਮ ਨਹਿਰਾਂ ਦਾ ਅਤੇ ਖਾਲਿਆਂ ਦਾ ਪਾਣੀ ਪੀਣ ਯੋਗ ਉਹਨੂੰ ਵਰਤ ਲੈਂਦੇ ਸੀ ਅਤੇ ਹਾਂਜੀ ਅਤੇ ਇਕੱਠਾ ਕਰਕੇ ਵੀ ਰੱਖ ਲੈਂਦੇ ਸੀ ਪਾਣੀ ਠੀਕ ਹੈ ਜੀ ਹੁਣ ਪਾਣੀ ਆ ਜਿਹੜਾ ਥੱਲੇ ਵਹਿੰਦਾ ਜਾ ਰਿਹਾ ਜੀ ਪਾਣੀ ਦੀ ਸਤਹ ਆ ਨਾ ਜਿਹੜੀ ਥੱਲੇ ਰਿੜ੍ਹਦੀ ਜਾ ਰਹੀ ਹੈ ਤਾਂ ਜੋ ਸਾਨੂੰ ਪਾਣੀ ਹੈ ਜਿਹੜਾ ਉਹ ਬਚਣਾ ਬਹੁਤ ਜਰੂਰੀ ਹੈ ਠੀਕ ਹੈ ਪਾਣੀ ਦੀ ਬਚਤ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ ਅਤੇ ਸਾਨੂੰ ਘਰਾਂ ਦੇ ਵਿੱਚ ਨਾ ਜਿਹੜਾ ਪਾਣੀ ਆ ਉਹਨੂੰ ਮਤਲਬ ਕਿ ਸਹੀ ਤਰੀਕੇ ਨਾਲ ਵਰਤਣਾ ਚਾਹੀਦਾ ਤਾਂ ਜੋ ਕਿ ਪਾਣੀ ਦੀ ਯੂਸੇਜ ਬਹੁਤ ਵਧੀਆ ਹੋ ਠੀਕ ਹੈ ਜੀ ਹਾਂਜੀ ਅਤੇ ਹੁਣ ਮਤਲਬ ਕਿ ਆਪਾਂ ਕਹਿੰਦੇ ਹਾਂ ਭਾਈ ਪਾਣੀ ਮਤਲਬ ਕਹੀ ਜਾਂਦੇ ਹਾਂ ਇੱਕ ਤਾਂ ਹਾਂਜੀ ਪਾਣੀ ਬਾਰੇ ਠੀਕ ਹੈ ਜੀ ਹਾਂਜੀ ਥੈਂਕ ਯੂ ਜੀ ਓਕੇ